ਦੌੜਨਾ ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦਾ ਦੌੜਨਾ ਸਾਡਾ ਸਰੀਰ ਤੰਦਰੁਸਤ ਰਹਿੰਦਾ ਜਦੋਂ ਅਸੀਂ ਸਵੇਰੇ ਉੱਠ ਕੇ ਸੈਰ ਕਰਨ ਜਾਦੇ ਆਂ ਜਲਦੀ ਉੱਠ ਕੇ ਤੇ ਸਾਡਾ ਸਰੀਰ ਪੂਰਾ ਚੁਸਤੀ ਫੁਰਤੀ ਵਾਲਾ ਰਹਿੰਦਾ ਸਾਨੂੰ ਕੰਮ ਕਰਨ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ਸਾਨੂੰ ਹਮੇਸ਼ਾ ਸਵੇਰੇ ਜਲਦੀ ਉੱਠ ਕੇ ਦੌੜਨਾ ਚਾਹੀਦਾ ਇਸ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਸਾਡੇ ਸਰੀਰ ਵਿੱਚ ਤੰਦਰੁਸਤੀ ਰਹਿੰਦੀ ਆ ਸਾਡਾ ਮਨ ਸ਼ਾਂਤ ਰਹਿੰਦਾ ਜਦੋਂ ਸਵੇਰ ਦੀ ਜਿਹੜੀ ਠੰਡੀ ਠੰਡੀ ਹਵਾ ਸਾਡੇ ਸਰੀਰ ਦੇ ਵਿੱਚ ਪੈਂਦੀ ਆ ਸਾਡਾ ਸਰੀਰ ਪੂਰੀ ਤੌਰ ਤੇ ਤੰਦਰੁਸਤ ਹੋ ਜਾਂਦਾ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਆ ਸਾਨੂੰ ਸਵੇਰੇ ਉੱਠ ਕੇ ਵੀ ਦੌੜਨਾ ਚਾਹੀਦਾ ਸਾਨੂੰ ਰਾਤ ਨੂੰ ਜਦੋਂ ਅਸੀਂ ਰੋਟੀ ਖਾ ਲੈਦੇ ਆ ਫਿਰ ਸੈਰ ਕਰਨੀ ਚਾਹੀਦੀ ਆ ਇਹਦੇ ਨਾਲ ਵੀ ਸਾਡਾ ਸਰੀਰ ਤੰਦਰੁਸਤ ਰਹਿੰਦਾ ਜਦੋਂ ਵੀ ਅਸੀਂ ਦੌੜਦੇ ਆਂ ਉਸ ਤੋਂ ਬਾਅਦ ਸਾਡਾ ਸਰੀਰ ਪੂਰਾ ਚੰਗੀ ਤਰਾਂ ਆਰਾਮ ਮਹਿਸੂਸ ਕਰਦਾ ਗਾ ਸਾਨੂੰ ਇਦਾਂ ਲੱਗਦਾ ਜਿਦਾਂ ਵੀ ਕੋਈ ਬਿਮਾਰੀ ਨਹੀਂ ਨਹੀਂ ਲੱਗਦੀ ਠੀਕ ਆ ਸਾਨੂੰ ਹਮੇਸ਼ਾ ਦੌੜਦੇ ਰਹਿਣਾ ਚਾਹੀਦਾ ਭੱਜਣਾ ਚਾਹੀਦਾ ਸੈਰ ਕਰਨੀ ਚਾਹੀਦੀ ਆ ਜਿਹਦੇ ਨਾਲ ਸਾਡੀ ਸਿਹਤ ਤੰਦਰੁਸਤ ਰਹਿੰਦੀ ਆ ਸਾਨੂੰ ਕਿਸੇ ਤਰਹਾਂ ਦੀ ਕੋਈ ਬਿਮਾਰੀ ਨਹੀਂ ਲੱਗਦੀ ਜਦੋਂ ਅਸੀਂ ਸਵੇਰ ਦੀ ਸੈਰ ਕਰਦੇ ਆਂ ਉਹਦੇ ਨਾਲ ਜਿਵੇਂ ਬਰਾਡ ਸ਼ੂ ਬਲੱਡ ਸ਼ੂਗਰ ਬਲੱਡ ਪ੍ਰੈਸ਼ਰ ਕਈ ਤਰਹਾਂ ਦੀਆਂ ਬਿਮਾਰੀਆਂ ਤੋਂ ਸਾਨੂੰ ਮੁਕਤੀ ਮਿਲਦੀ ਆ ਜਦੋਂ ਅਸੀਂ ਦੌੜਦੇ ਆ ਸਾਡਾ ਸਰੀਰ ਰਿਲੈਕਸ ਮਹਿਸੂਸ ਕਰਦੇ ਆਰਾਮ ਮਿਲਦਾ ਸਾਨੂੰ ਦੌੜਨ ਨਾਲ ਸਨ ਇਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਜਦੋਂ ਵੀ ਅਸੀਂ ਭੱਜਦੇ ਆਂ ਸਾਡਾ ਸਰੀਰ ਪੂਰਾ ਰੈਸਟ ਪੁਸ਼ਟ ਹੋ ਜਾਂਦਾ ਤੰਦਰੁਸਤ ਰਹਿੰਦਾ ਥੱਕਿਆ ਥੱਕਿਆ ਮਹਿਸੂਸ ਨਹੀਂ ਕਰਦਾ